ਪੰਜਾਬੀ ਲੋਕ ਆਪਣੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਮਨਾਉਣ ਦੇ ਲਈ ਜਿੱਦਾਂ ਅਸੀਂ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੇ ਹਾਂ ਜੀ ਅਤੇ ਬੱਚੇ ਨੂੰ ਆਪਣੇ ਗੁਰੂ ਸਾਹਿਬਾਨ ਨਾਲ ਜੋੜਨਾ ਗੁਰਬਾਣੀ ਦੀਆਂ ਤੁਕਾਂ ਗਾਉਣੀਆਂ ਹੈ ਨਾ ਅਤੇ ਇਸ ਤੋਂ ਇਲਾਵਾ ਸਾਡੀਆਂ ਜਿਹੜੇ ਡਰੈੱਸ ਆ ਗਏ ਉਹ ਵੀ ਪੰਜਾਬੀ ਜਿਹੜਾ ਪੰਜਾਬੀ ਸੂਟ ਚਾਦਰੇ ਅਤੇ ਇਹ ਚੀਜ਼ਾਂ ਪੰਜਾਬੀ ਸੱਭਿਆਚਾਰ ਨੂੰ ਜਿਹੜੀਆਂ ਸਾਂਭ ਕੇ ਰੱਖਣ ਦੇ ਵਿੱਚ ਸਾਡੀ ਮਦਦ ਕਰਦੀਆਂ ਨੇ ਫਿਰ ਪੰਜਾਬੀ ਲੋਕ ਨੇ ਜਿਹੜੇ ਆਪਣੀ ਹਰ ਜਿਹੜੀ ਖੁਸ਼ੀ ਹੈਗੀ ਉਹ ਗਿੱਧੇ ਭੰਗੜੇ ਪਾ ਕੇ ਹੀ ਨਾ ਉਸਨੂੰ ਮਨਾਉਂਦੇ ਨੇ ਅਤੇ ਬੋਲੀਆਂ ਪਾਉਣੀਆਂ ਗਿੱਧੇ ਪਾਉਣੇ ਇਹ ਸਭ ਪੰਜਾਬੀ ਜਿਹੜਾ ਸੱਭਿਆਚਾਰ ਦਾ ਜਿਹੜਾ ਉਸਦੇ ਮਾਣ ਨੂੰ ਕਾਫੀ ਹੋਰ ਵਧਾਉਂਦੇ ਨੇ ਅਤੇ ਸਾਡੀ ਪੰਜਾਬੀ ਜਿਹੜੀ ਬੋਲੀ ਹੈ ਉਹ ਬੜੀ ਪਿਆਰੀ ਮਿੱਠੀ ਹੈ ਅਤੇ ਇਸੇ ਤਰ੍ਹਾਂ ਹੀ ਅਸੀਂ ਆਪਣੇ ਸੱਭਿਆਚਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੇ ਹਾਂ